ਸਾਡੇ ਪੰਜਾਬ ਖੇਤਰ ਵਿੱਚ ਅਕਸਰ ਦੇਖੇ ਜਾਣ ਵਾਲੇ ਕੁਝ ਪ੍ਰਸਿੱਧ ਪੰਛੀ ਹਨ ਕਬੂਤਰ ਕਾਂਗ ਬੁਲਬੁਲ ਪਿਓ ਬਗਲਾ ਕੋਆ ਚਿੜੀ ਮੇਰਾ ਮਨਪਸੰਦ ਪੰਛੀ ਬੁਲਬੁਲ ਹੈ ਇਹ ਆਪਣੇ ਸੁਰੀਲੇ ਗੀਤ ਅਤੇ ਸੋਹਣੀ ਰੰਗਤ ਕਾਰਨ ਬਹੁਤ ਮਸ਼ਹੂਰ ਹੈ ਬੁਲਬੁਲ ਦੀ ਮਿੱਠੀ ਅਵਾਜ਼ ਸਵੇਰ ਦੇ ਸਮੇਂ ਬਹੁਤ ਸੁਖਦਾਈ ਲੱਗਦੀ ਹੈ ਅਤੇ ਇਹ ਦੇਖਣ ਵਿੱਚ ਵੀ ਬਹੁਤ ਖੂਬਸੂਰਤ ਹੁੰਦੀ ਹੈ ਕਬੂਤਰ ਕਬੂਤਰ ਪੰਜਾਬ ਦੇ ਹਰ ਗਾਓਂ ਅਤੇ ਸ਼ਹਿਰਾਂ ਵਿੱਚ ਬਹੁਤ ਘੁੰਮਣ ਵਾਲੇ ਹਨ ਇਹ ਤਾਂ ਸੰਗੀਤਮਈ ਸੋਧ ਬਹੁਤ ਮਸ਼ਹੂਰ ਹੈ ਗਿੱਦੜ ਪੰਜਾਬ ਦਾ ਰਾਜਾ ਮੰਨਿਆ ਜਾਂਦਾ ਹੈ ਇਹ ਵੱਡੇ ਅਤੇ ਸੁੰਦਰ ਪੰਛੀ ਹਨ ਜੋ ਖੇਤਰ ਵਿੱਚ ਆਪਣੇ ਆਕਾਰਾਂ ਨਾਲ ਚਮਕਦੇ ਹਨ ਸਪੋਟੇਟ ਵੇਲ ਇਹ ਵੱਡਾ ਅਤੇ ਪਾਸੇਦਾਰ ਪੰਛੀ ਹੁੰਦਾ ਹੈ ਪੰਛੀ ਅਤੇ ਪੰਜਾਬ ਦੇ ਕੁਝ ਖੇਤਰਾਂ ਵਿੱਚ ਪਾਇਆ ਜਾਂਦਾ ਹੈ ਇਹ ਗਿਣਤੀ ਨਾਲ ਬਹੁਤ ਹੋਣ ਦੇ ਨਾਲ ਹਰ ਪੰਛੀ ਨੇ ਆਪਣੀਆਂ ਵਿਸ਼ੇਸ਼ਤਾਵਾਂ ਅਤੇ ਆਕਾਰਾਂ ਵਿੱਚ ਖਾਸੀਅਤ ਰੱਖਦਾ ਹੈ ਜੋ ਉਨ੍ਹਾਂ ਨੂੰ ਇਨਸਾਨਾਂ ਦੇ ਨਜ਼ਰੀਏ ਵਿੱਚ ਸਿਆਹੀ ਪੰਛੀ ਬਣਾਉਂਦਾ ਹੈ